ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਅੱਛਾ ਜੀ ਹਾਂਜੀ ਮਾਨਸਾ ਦੇ ਵਿੱਚ ਹਾਂ ਨਸ਼ਾ ਫੜਿਆ ਗਿਆ ਹੈਗਾ ਅਸੀਂ ਨੇ ਕਾਰਵਾਈ ਜਿਹੜੀ ਬਣਦੀ ਕਾਰਵਾਈ ਆ ਉਹ ਕਰੀ ਆ ਅਸੀਂ ਨੇ ਠੀਕ ਹੈ ਅੱਛਾ ਹਾਂ ਅਤੇ ਬਾਕੀ ਕੇਸ ਪਾਤਾ ਉਹਨਾਂ 'ਤੇ ਰਿਮਾਂਡ ਤਾਂ ਲੈਣਾ ਹੀ ਪੈਂਦਾ ਉਹਨਾਂ ਉਹ ਆਪਣਾ ਉਹਨਾਂ ਤੋਂ ਰਿਮਾਂਡ ਤਾਂ ਲਵਾਂਗੇ ਹੀ ਲਵਾਂਗੇ ਉਹਨਾਂ ਨੂੰ ਹਾਂ ਇਹ ਇਹ ਆਪਣਾ ਜਿਹੜਾ ਮਾਨਸਾ ਦੇ ਬੰਦੇ ਫੜੇ ਨੇ ਅਸੀਂ ਨੇ ਠੀਕ ਹੈ ਉਹ ਇੱਕ ਗਰੋਹ ਹੈ ਠੀਕ ਹੈ ਜਿਹੜਾ ਕਿ ਗਰੋਹ ਦੇ ਮੁਤਾਬਕ ਹੀ ਚੇਨਾ ਦੇ ਮੁਤਾਬਕ ਹੀ ਇਹ ਸਪਲਾਈ ਹੁੰਦਾ ਠੀਕ ਹੈ ਮੇਨ ਬੰਦੇ ਮਾਨਸਾ ਦੀ ਨਹੀਂ ਹੈਗੇ ਬਾਕੀ ਹੋਰ ਇਲਾਕਿਆਂ ਦੇ ਵੀ ਨੇ ਅਤੇ ਉਸ ਦੇ ਦੌਰਾਨ

ਪੋਲੀਟਿਕਸ ਦਾ ਵੀ ਹੋ ਸਕਦਾ ਬਾਕੀ ਤੁਹਾਨੂੰ ਦੱਸੀ ਜਾਂਦਾ ਵੀ ਗਰੋਹ ਨੇ ਜੀ ਇਹ ਬਹੁਤ ਵੱਡੇ ਤੋਂ ਵੱਡਾ ਗਰੋਹ ਹੈ ਠੀਕ ਹੈ ਨਾ ਉਸ ਦੇ ਮੁਤਾਬਕ ਇਹ ਹਰੇਕ ਇਲਾਕੇ ਦੇ ਮੁਤਾਬਕ ਚੇਨਾਂ ਦੇ ਮੁਤਾਬਕ ਇਹ ਸਪਲਾਈ ਹੁੰਦਾ ਠੀਕ ਹੈ ਪੋਲੀਟਿਕਸ ਦਾ ਹੱਥ ਵੀ ਹੈ ਪੋਲੀਟਿਕਸ ਦਾ ਵੀ ਹੱਥ ਹੈ ਬਹੁਤ ਜ਼ਿਆਦਾ ਪੋਲੀਟਿਕਸ ਦਾ ਹੱਥ ਹੈ ਠੀਕ ਐਸ ਐਸ ਪੀ ਸਾਹਿਬ ਵੀ ਨੇ ਡੀ ਐਸ ਪੀ ਸਾਹਿਬ ਵੀ ਨੇ ਹਾਂਜੀ ਓਕੇ ਜੀ